ਸਾਡੇ ਖੇਤਰ ਵਿੱਚ ਮੁਰਗੀ ਪਾਲਣ ਪਿਗ ਫਾਰਮ ਅਤੇ ਸਬਜ਼ੀ ਬੀਜਣ ਵਾਲਾ ਕਾਰੋਬਾਰ ਕੀਤਾ ਜਾ ਸਕਦਾ ਹੈ ਇਹਨਾਂ ਵਿੱਚੋਂ ਮੈਂ ਸਬਜ਼ੀ ਬੀਜਣ ਵਾਲਾ ਕਾਰੋਬਾਰ ਕਰਾਂਗਾ ਕਿਉਂਕਿ ਇਸ ਕਾਰੋਬਾਰ ਤੋਂ ਬਹੁਤ ਜ਼ਿਆਦਾ ਮੁਨਾਫਾ ਮਿਲਦਾ ਹੈ ਅਤੇ ਘਰ ਵਿੱਚ ਵਰਤਣ ਲਈ ਸਾਫ ਸੁਥਰੀ ਅਤੇ ਤਾਜ਼ੀ ਸਬਜ਼ੀ ਮਿਲਦੀ ਹੈ